ਡਰਾਇੰਗ ਮੇਰਾ ਬਚਪਨ ਦਾ ਸ਼ੌਕ ਹੈ ਜਦ ਮੈਂ ਛੋਟੀ ਹੁੰਦੀ ਸੀ ਸਕੂਲ ਜਾਂਦੀ ਸੀ ਤਾਂ ਮੈਂ ਕਈ ਕਲਾਕਾਰਾਂ ਦੀਆਂ ਫੋਟੋਆਂ ਬਣਾਈਆਂ ਜਿਨ੍ਹਾਂ ਵਿੱਚੋਂ ਸ਼ਹੀਦ ਭਗਤ ਸਿੰਘ ਜੀ ਗਿੱਪੀ ਗਰੇਵਾਲ ਮਹਾਤਮਾ ਜੀ ਨਰਿੰਦਰ ਮੋਦੀ ਜੀ ਸਾਰਿਆਂ ਦੀਆਂ ਡਰਾਇੰਗਸ ਬਣਾ ਲੈਂਦੀ ਹਾਂ ਜਿਹਨਾਂ ਨੂੰ ਵੇਖ ਕੇ ਮੇਰੇ ਟੀਚਰਾਂ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ ਉਹਨਾਂ ਨੂੰ ਇਹ ਸਾਰੀਆਂ ਡਰਾਇੰਗਸ ਬਹੁਤ ਪਸੰਦ ਆਈਆਂ ਮੈਂ ਕਈ ਤਰ੍ਹਾਂ ਦੀਆਂ ਡਰਾਇੰਗਸ ਬਣਾ ਲੈਂਦੀ ਹਾਂ ਮੈਨੂੰ ਡਰਾਇੰਗਸ ਕਰਨੀ ਬਹੁਤ ਚੰਗੀ ਲੱਗਦੀ ਹੈ ਮੈਂ ਹਮੇਸ਼ਾ ਇਹ ਕੰਮ ਖੁੱਲ੍ਹੇ ਦਿਲ ਤੋਂ ਕਰਦੀ ਹਾਂ ਇਹ ਡਰਾਇੰਗ ਮੇਰਾ ਮਨ ਪਸੰਦ ਕੰਮ ਹੈ ਜਦ ਵੀ ਬਣਾਉਂਦੀ ਹਾਂ ਪੂਰੇ ਦਿਲ ਤੋਂ ਹੀ ਬਣਾਉਂਦੀ ਹਾਂ ਮੈਨੂੰ ਇਹ ਡਰਾਇੰਗ ਬਣਾਉਣਾ ਬਹੁਤ ਪਸੰਦ ਹੈ ਵਾਤਾਵਰਨ ਦੀ ਡਰਾਇੰਗ ਵੀ ਬਣਾ ਲੈਂਦੀ ਹਾਂ ਇੱਕ ਆਦਮੀ ਮੇਰੇ ਸਾਹਮਣੇ ਖੜ੍ਹਾ ਹੋਵੇ ਮੈਂ ਉਸ ਨੂੰ ਵੀ ਡਰਾਇੰਗ ਪ੍ਰਤੀ ਉਤਾਰ ਸਕਦੀ ਹਾਂ ਮੈਂ ਆਪਣੀ ਕਲਾ ਨੂੰ ਦੁਨੀਆਂ ਨੂੰ ਦਿਖਾਉਣਾ ਚਾਹੁੰਦੀ ਹਾਂ